ਹਾਂਜੀ ਮੈਂ ਅੱਜ ਤੁਹਾਡੇ ਨਾਲ ਆਪਣੇ ਅਖ਼ਬਾਰਾਂ ਦੇ ਬਾਰੇ ਗੱਲਬਾਤ ਕਰਨਾ ਚਾਹੁੰਦਾ ਵੀ ਮੈਨੂੰ ਕਿਸ ਤਰ੍ਹਾਂ ਦੇ ਅਖ਼ਬਾਰ ਪੜ੍ਹਨੇ ਪਸੰਦ ਨੇ ਜਾਂ ਅਖ਼ਬਾਰਾਂ ਦੇ ਵਿੱਚ ਮਤਲਬ ਵੱਖਰਾ ਵੱਖਰਾ ਕੀ ਹੈ ਅਖ਼ਬਾਰ ਕਈ ਤਰ੍ਹਾਂ ਦੇ ਆਉਂਦੇ ਜਿਵੇਂ ਸਾਡੇ ਜ਼ਿਲ੍ਹੇ ਦੇ ਵਿੱਚ ਮਾਨਸਾ ਦੇ ਵਿੱਚ ਜਗ ਬਾਣੀ ਹੋ ਗਿਆ ਪੰਜਾਬੀ ਟ੍ਰਿਬਿਊਨ ਅਤੇ ਹੋਰ ਵੀ ਕਾਫ਼ੀ ਅਜੀਤ ਅਖ਼ਬਾਰ ਹੋ ਗਿਆ ਕਾਫ਼ੀ ਅਖ਼ਬਾਰ ਆਉਂਦੇ ਹਨ ਪਰੰਤੂ ਮੈਂ ਇਹ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਪੰਜਾਬੀ ਟ੍ਰਿਬਿਊਨ ਅਖ਼ਬਾਰ ਨੂੰ ਪੜ੍ਹਨਾ ਪਸੰਦ ਕਰਦਾ ਹਾਂ ਕਿਉਂਕਿ ਇਹਦੇ ਵਿੱਚ ਕਾਫ਼ੀ ਖ਼ਬਰਾਂ ਐਕੁਰੇਟ ਤਰੀਕੇ ਨਾਲ ਦਿਖਾਈਆਂ ਹੁੰਦੀਆਂ ਹਨ ਅਤੇ ਸਾਡੇ ਜ਼ਿਲ੍ਹੇ ਨਾਲ ਰਿਲੇਟਡ ਖ਼ਬਰਾਂ ਸ਼ੋ ਹੁੰਦੀਆਂ ਹਨ ਇਸ ਦੇ ਵਿੱਚ ਕੀ ਹੈ ਕਿ ਇਸ ਤੋਂ ਇਲਾਵਾ ਬ੍ਰਿਲਸ ਅਖ਼ਬਾਰ ਆਉਂਦਾ ਹੈ ਪੰਜਾਬੀ ਦਾ ਜੋ ਹਿੰਦੀ ਅਤੇ ਇੰਗਲਿਸ਼ ਵਿੱਚ ਆਉਂਦਾ ਹੈ ਉਹਦੇ ਵਿੱਚ ਕੀ ਹੈ ਕਿ ਉਹਦੇ ਵਿੱਚ ਹਿੰਦੀ ਦੇ ਖ਼ਬਰ ਜੋ ਵੀ ਲਗਾਈ ਹੁੰਦੀ ਆ ਉਸ ਦਾ ਇੱਕ ਹਿੰਦੀ ਦੇ ਵਿੱਚ ਵਰਜਨ ਟਰਾਂਸਲੇਟ ਕੀਤਾ ਹੁੰਦਾ ਹੈ ਅਤੇ ਹਿੰਦੀ ਦਾ ਹੀ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕੀਤਾ ਹੁੰਦਾ ਹੈ ਜਿਹਦੇ ਵਿੱਚ ਸਿੱਖਣ ਨੂੰ ਕਾਫ਼ੀ ਕੁਛ ਮਿਲਦਾ ਹੈ ਕਿਉਂਕਿ ਅੱਜ ਦੇ ਜ਼ਮਾਨੇ ਵਿੱਚ ਇੰਗਲਿਸ਼ ਸਿੱਖਣਾ ਲੋਕਾਂ ਲਈ ਬਹੁਤ ਔਖਾ ਕੰਮ ਹੈ ਪਰ ਜਿਸ ਹਿਸਾਬ ਨਾਲ ਅਖ਼ਬਾਰ ਦੇ ਵਿੱਚ ਸਿੱਖਣ ਨੂੰ ਦਿਖਾਇਆ ਹੁੰਦਾ ਹੈ ਕਹਾਣੀਆਂ ਬਣਾ ਕੇ ਸਿੱਖਣ ਨੂੰ ਦਿਖਾਇਆ ਹੁੰਦਾ ਹੈ ਖ਼ਬਰਾਂ ਦੇ ਰਾਹੀਂ ਸਿਖਾਇਆ ਹੁੰਦਾ ਹੈ ਤਾਂ ਉਸਨੂੰ ਇਸ ਅਖ਼ਬਾਰ ਨੂੰ ਪੜ੍ਹਨਾ ਕਾਫ਼ੀ ਸੌਖਾ ਇਹ ਅਖ਼ਬਾਰ ਮੈਂ ਕਾਫ਼ੀ ਸਮੇਂ ਤੋਂ ਪੜ੍ਹ ਰਿਹਾ ਹਾਂ ਅਤੇ ਇਹ ਹਰ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਅਖ਼ਬਾਰ ਆਉਂਦਾ ਹੈ ਹਫ਼ਤੇ ਦੇ ਵਿ ਦੇ ਵਿੱਚ ਦੋ ਦਿਨ ਆਉਂਦਾ ਹੈ ਅਤੇ ਬਾਕੀ ਦੇ ਪੰਜ ਦਿਨਾਂ ਵਿੱਚ ਮੈਂ ਦੂਜੇ ਅਖ਼ਬਾਰ ਪੜ੍ਹਦਾ ਹਾਂ ਜੋ ਕਿ ਆਸ ਪਾਸ ਦੀਆਂ ਖ਼ਬਰਾਂ ਦਾ ਪਤਾ ਚੱਲਦਾ ਰਹਿੰਦਾ ਹੈ ਜੋ ਵੀ ਕੋਈ ਘਟਨਾ ਹੋਈ ਹੈ ਜਾਂ ਕੋਈ ਵੀ ਕੋਈ ਸਕੀਮ ਸ਼ੁਰੂ ਹੋਈ ਆ ਕੋਈ ਜੋਬ ਪਤਾ ਕਰਨੀ ਆ ਉਸ ਦੇ ਸੰਬੰਧ ਵਿੱਚ ਮੈਂ ਸਾਰੇ ਅਖ਼ਬਾਰ ਇੱਕ ਵਾਰ ਜ ਦੇਖਦਾ ਜ਼ਰੂਰ ਹਾਂ ਅਤੇ ਸਭ ਤੋਂ ਸੌਖਾ ਤਰੀਕਾ ਇੰਗਲਿਸ਼ ਸਿੱਖਣ ਦੇ ਲਈ ਬ੍ਰਿਲਸ ਅਖ਼ਬਾਰ ਹੈ ਜੋ ਜਿਸ ਦੇ ਰਾਹੀਂ ਅਸੀਂ ਇੰਗ ਇੰਗਲਿਸ਼ ਸਿੱਖ ਸਕਦੇ ਹਾਂ